ਸਤਿ ਸ਼੍ਰੀ ਅਕਾਲ ਜੀ ਮੇਰੀ ਗੱਲ ਮੋਹਾਲੀ ਦੇ ਸਪੋਰਟਸ ਕਲੱਬ ਵਿੱਚ ਹੋ ਰਹੀ ਹੈ ਮੈਂ ਨਾ ਆਪਣੇ ਬੱਚੇ ਬਾਰੇ ਪਤਾ ਕਰਨਾ ਸੀ ਮੇਰਾ ਇੱਕ ਬੱਚਾ ਏ ਸੱਤ ਪੰਜ ਸਾਲ ਦਾ ਓਹਦੇ ਲਈ ਨਾ ਕੋਈ ਸਪੋਰਟਸ ਪੁੱਛਣੀ ਸੀ ਵੀ ਉਹ ਪਾਰਟੀਸਪੇਟ ਕਰ ਸਕਦਾ ਹੈ ਕਿਸੇ ਵਿੱਚ ਹਾਂਜੀ ਠੀਕ ਠੀਕ ਹੈ ਮੈਨੂੰ ਠੀਕ ਹੈ ਮੈਨੂੰ ਸਵੀਮਿੰਗ ਲਈ ਪਤਾ ਕਰਨਾ ਸੀ ਤੁਸੀਂ ਸਵੀਮਿੰਗ ਕਿੱਦਾ ਸਿਖਾਉਂਦੇ ਓ ਹੈਜੀ ਸਿਕਸ ਈਅਰ ਹਾਂਜੀ ਹਾਂਜੀ ਹਾਂ ਸੇਫਟੀ ਵਗੈਰਾ ਦਾ ਖਾਸ ਧਿਆਨ ਹੈਗਾ ਨਾ ਤੁਹਾਡੇ ਕੋਲ ਠੀਕ ਹੈ ਜੀ ਬਾਕੀ ਆਪਣੀ ਫੀਸ ਸਟਰੱਕਚਰ ਕੀ ਹੋਏਗੀ ਇਹਦੇ ਲਈ ਹਾਂਜੀ ਅੱਛਾ ਠੀਕ ਹੈ ਜੀ ਤੇ ਬਾਕੀ ਟਾਈਮਿੰਗਜ਼ ਕੀ ਰਹਿਣਗੀਆਂ ਓਕੇ ਜੀ ਟੇਨ ਤੋਂ ਟਵੈਲਵ ਠੀਕ ਆ ਮੈਂ ਮੰਡੇ ਨੂੰ ਵਿਜ਼ਿਟ ਕਰਲਾਗਾ ਤੁਹਾਡੇ ਉੱਥੇ ਠੀਕ ਹੈ